ਯੋਗਾ ਕਰਨ ਤੋਂ ਪਹਿਲਾਂ ਸਾਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਸੀ ਸਾਡੇ ਸਰੀਰ ਵਿੱਚ ਕਈ ਬਿਮਾਰੀਆਂ ਹੈਗੀਆਂ ਸੀ ਯੋਗਾ ਕਰਨ ਨਾਲ ਸਾਨੂੰ ਬਹੁਤ ਫਾਇਦਾ ਹੋਇਆ ਜੀ ਸਵੇਰੇ ਅਸੀਂ ਜਲਦੀ ਟਾਈਮ ਨਾਲ ਉੱਠ ਜਾਂਦੇ ਹਾਂ ਰਾਤ ਨੂੰ ਸਾਨੂੰ ਨੀਂਦ ਨਹੀਂ ਆਉਂਦੀ ਸੀ ਜੀ ਯੋਗਾ ਕਰਨ ਨਾਲ ਸਾਨੂੰ ਬੜੀ ਸਾਨੂੰ ਬੜੀ ਫਾਇਦੇਮੰਦ ਹੋਇਆ ਯੋਗਾ ਕਰਨ ਦੇ ਵਿੱਚ ਰੂਟੀਨ ਦੇ ਵਿੱਚ ਅਸੀਂ ਕਈ ਤਰ੍ਹਾਂ ਦੇ ਯੋਗਾ ਕਰਦੇ ਹਾਂ ਜਿਵੇਂ ਕਿ ਸ਼ੀਸ਼ ਆਸਣ ਸਰਵਾਂਗ ਆਸਣ ਸ਼ਵ ਆਸਣ ਮੈਡੀਟੇਸ਼ਨ ਅਤੇ ਸਰੀਰ ਉਸ ਦੇ ਨਾਲ ਸਾਡਾ ਤੰਦਰੁਸਤ ਰਹਿੰਦਾ ਸਾਨੂੰ ਨੀਂਦ ਬੜੀ ਅੱਛੀ ਆਉਂਦੀ ਹੈ ਰਾਤ ਨੂੰ ਅਸੀਂ ਜਿਸ ਤਰ੍ਹਾਂ ਪਹਿਲਾਂ ਸਾਨੂੰ ਨੀਂਦ ਨਹੀਂ ਆਉਂਦੀ ਸੀ ਰਾਤ ਨੂੰ ਅਸੀਂ ਸਾਰੀ ਰਾਤ ਜਾਗਦੇ ਰਹਿੰਦੇ ਸੀ ਯੋਗਾ ਕਰਨ ਨਾਲ ਸਾਨੂੰ ਸਰੀਰ ਦੇ ਵਿੱਚ ਸਫੁਰਤੀ ਆਉਂਦੀ ਹੈ